ਸਰਦਾਰ ਗੁਰਬਿੰਦਰ ਪਾਲ ਸਿੰਘ ਸੋਢੀ ਸਰਦਾਰ ਹਰਮਨ ਜਾਪ ਸਿੰਘ ਕਲਸੀ ਸਰਦਾਰ ਦਵਿੰਦਰ ਦੀਪ ਸਿੰਘ ਰਾਮਗੜੀਆ ਸਰਦਾਰ ਕੁਵਰ ਪ੍ਰਤਾਪ ਵੀਰ ਸਿੰਘ ਸੰਧਾਵਾਲੀਆ ਸਰਦਾਰ ਹਰੀਮੰਦਰ ਸਿੰਘ ਮਜੀਠੀਆ